ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਬਸ ਸਾਡਾ ਵਧੀਆ ਤੁਸੀਂ ਆਪਣਾ ਸੁਣਾਓ ਕਿੱਦਾਂ ਬੱਚੇ ਮੇਰੇ ਵੀ ਠੀਕ ਆ ਤੁਸੀਂ ਆਪਣਾ ਸੁਣਾਓ ਘਰ ਕਿੱਦਾਂ ਸਾਰੇ ਠੀਕ ਆ ਹਾਂਜੀ ਕਿੱਦਾਂ ਤੁਸੀਂ ਆ ਨਿੱਕੇ ਦੀ ਅਡਮਿਸ਼ਨ ਦਾ ਸੋਚਿਆ ਇਸ ਵਾਰ ਕਿਉਂਕਿ ਮਤਲਬ ਹੁਣ ਮੈਂ ਸੋਚਦੀ ਸੀ ਕਿ ਆਪਣੇ ਬੱਚੇ ਤਿੰਨ ਥ੍ਰੀ ਪਲੱਸ ਹੋ ਗਏ ਤਿੰਨ ਸਾਲ ਤੋਂ ਉੱਪਰ ਦੇ ਹੋ ਗਏ ਅਤੇ ਆਪਾਂ ਇਹਨਾਂ ਦੀ ਅਡਮਿਸ਼ਨ ਕਰਵਾਈਏ ਹਾਂਜੀ ਮੈਂ ਵੀ ਇਹੀ ਸੋਚਦੀ ਸੀ ਕਿਉਂਕਿ ਜਿੱਦਾਂ ਹੁਣ ਮੁਸ਼ਹੂਰ ਤਾਂ ਬਹੁਤ ਸਾਰੇ ਸਕੂਲ ਆ ਹੈ ਨਾ ਕੋਈ ਕਈ ਪੰਜਾਬ ਬੋਰਡ ਨਾਲ ਸੰਬੰਧਿਤ ਆ ਕਈ ਆਈ ਸੀ ਐਸ ਈ ਬੋਰਡ ਨਾਲ ਕਈ ਸੀ ਬੀ ਐਸ ਈ ਬੋਰਡ ਨਾਲ ਸੰਬੰਧਿਤ ਆ ਅਤੇ ਵੀ ਹੁਣ ਸਮਝ ਵੀ ਨਹੀਂ ਆਉਂਦੀ ਸੀ ਵੀ ਕਿਹੜੇ ਸਕੂਲ 'ਚ ਪਾਈਏ ਮੈਂ ਕਿਹਾ ਚਲੋ ਤੁਹਾਡੇ ਨਾਲ ਡਿਸਕਸ ਕੀਤਾ ਜਾਵੇ ਕਿ ਆਪਾਂ ਕਿਹੜੇ ਸਕੂਲ 'ਚ ਬੱਚੇ ਨੂੰ ਲਗਾਉਣਾ ਚਾਹੀਦਾ ਹੈ ਨਾ ਹਾਂਜੀ ਠੀਕ ਹੈ ਠੀਕ ਹੈ ਹੈ ਕੋਈ ਤੁਹਾਡੇ ਏਰੀਏ 'ਚ ਇੱਦਾਂ ਦਾ ਸਕੂਲ ਜਿਹੜਾ ਆਪਣਾ ਇਤਿਹਾਸ ਮਤਲਬ ਚਾਨਣਾ ਪਾਉਂਦੀਆਂ ਆਪਣੇ ਇਤਿਹਾਸ ਵਿੱਚ ਅੱਛਾ ਅੱਛਾ ਹਾਂਜੀ ਹਾਂਜੀ ਉਦਾਂ ਤਾਂ ਮੈਂ ਜਲੰਧਰ ਜ਼ਿਲ੍ਹੇ ਦੇ ਅੰਦਰ ਵੀ ਸ਼ਹਿਰ ਦੇ ਅੰਦਰ ਵੀ ਸੁਣਿਆ ਸੀਗਾ ਕਿ ਸੈਕਰਟ ਹਰਟਸ ਸਕੂਲ ਬਹੁਤ ਵਧੀਆ ਆ ਪਰ ਇਹ ਹੈ ਕਿ ਉਹਦਾ ਨਾ ਇੱਕ ਤਾਂ ਬੋਰਡ ਆਈ ਸੀ ਐਸ ਈ ਆ ਚਲ ਉਹ ਵੀ ਬੰਦਾ ਦੂਸਰਾ ਇਹ ਹੈ ਕਿ ਮੇਰੇ ਘਰ ਤੋਂ ਥੋੜ੍ਹਾ ਜ਼ਿਆਦਾ ਦੂਰ ਪੈ ਰਿਹਾ ਹੈ ਤਾਂ ਜਿਹਦੇ ਕਰਕੇ ਪੜ੍ਹਾਈ ਤਾਂ ਕਹਿੰਦੇ ਬਹੁਤ ਵਧੀਆ ਉੱਥੇ ਬਟ ਇੱਕ ਕੀ ਹੈ ਕਿ ਡ੍ਰੋਬੈਕ ਵੀ ਸਾਰਿਆਂ ਦੇ ਹੁੰਦੇ ਤੁਹਾਨੂੰ ਪਤਾ ਹੈ ਨਾ ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਕਹਿੰਦੇ ਫੀਸ ਸਟਰਕਚਰ ਬਹੁਤ ਜ਼ਿਆਦਾ ਆ ਅਡਮਿਸ਼ਨ ਫੀਸ ਵੀ ਬਹੁਤ ਜ਼ਿਆਦਾ ਲੈਂਦੇ ਪਏ ਆ ਅਤੇ ਦੂਸਰਾ ਇਹ ਹੈ ਪਈ ਡਿਸਟੈਂਸ ਬਹੁਤ ਜ਼ਿਆਦਾ ਪੈ ਰਿਹਾ ਆ ਜਿੱਦਾਂ ਜਿਸ ਸਕੂਲ 'ਚ ਤੁਸੀਂ ਦੱਸਦੇ ਪਏ ਇਹਨਾਂ 'ਚ ਕੋਕਰੀਕੁਲਰ ਐਕਟੀਵਿਟੀਜ਼ ਕਰਵਾਉਂਦੇ ਆ ਬੱਚਿਆਂ ਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਅੱਛਾ ਹਾਂ ਇਹ ਤਾਂ ਹੈ ਕਿ ਚਲੋ ਇਸ ਸਕੂਲ 'ਚ ਇਹ ਹੋਊਗਾ ਕਿ ਬੱਚਾ ਆਪਣੇ ਇਤਿਹਾਸ ਨਾਲ ਜੁੜੇਗਾ ਭਾਸ਼ਾ ਤਾਂ ਸਿੱਖਣੀ ਹੀ ਹੈ ਕਿਉਂਕਿ ਇੰਗਲਿਸ਼ ਮੀਡੀਅਮ ਸਕੂਲ ਹੈ ਨਾ ਅਤੇ ਬਟ ਇਹ ਹੈ ਕਿ ਜਿੱਦਾਂ ਹੁਣ ਇਸ ਸਕੂਲ ਨੂੰ ਵੈਸੇ ਤਾਂ ਬਹੁਤ ਵਧੀਆ ਸੀਗਾ ਬਟ ਉਹ ਦੂਰ ਪੈਣ ਦੇ ਚੱਕਰ ਦੇ ਵਿੱਚ ਨਾ ਇੱਕ ਅਡਮਿਸ਼ਨ ਫੀਸ ਬਹੁਤ ਆ ਤੁਹਾਨੂੰ ਪਤਾ ਹੁਣ ਇਨਕਮ ਵੀ ਇੰਨੀ ਨਹੀਂ ਹੁੰਦੀ ਹੈਗੀ ਕਿ ਜਿੰਨਾ ਆਪਾਂ ਸਾਰਾ ਕੁਛ ਐਜੂਕੇਸ਼ਨ 'ਤੇ ਹੀ ਡੋਨੇਟ ਕਰ ਦਈਏ ਹੈ ਨਾ ਹਾਂਜੀ ਹਾਂਜੀ ਅੱਛਾ ਅੱਛਾ ਮੈਂ ਅਫੋਰਡ ਕਰ ਸਕਦੇ ਆ ਠੀਕ ਆ ਠੀਕ ਹੈ ਆ ਕੋਈ ਨਹੀਂ ਠੀਕ ਆ ਮਹੀਨਾ ਵੀ ਬਰ ਫੀਸ ਹੀ ਲੈਂਦੇ ਹੈ ਨਾ ਬੱਸ ਕਰਾਇਆ ਤਾਂ ਨਹੀਂ ਜ਼ਿਆਦਾ ਲੈਂਦੇ ਕਿਉਂਕਿ ਅੱਜ ਕੱਲ੍ਹ ਉਹ ਵੀ ਆ ਨਾ ਕਿ ਬੱਸਾਂ 'ਚ ਵੀ ਏ ਸੀ ਹੁੰਦੇ ਆ ਯੇ ਆ ਵੋ ਆ ਉਹਦੇ ਕਰਕੇ ਬਸ ਫਿਰ ਖਰਚਾ ਬਹੁਤ ਵਧਾਇਆ ਜਾਂਦਾ ਆ ਅੱਛਾ ਅੱਛਾ ਕਿਉਂਕਿ ਦੋਵੇਂ ਹੀ ਸਕੂਲ ਫਿਰ ਮੇਰੇ ਤੋਂ ਡਿਸਟੈਂਸ ਤਾਂ ਸੇਮ ਹੀ ਹੋਣਾ ਆ ਹਾਂਜੀ ਹਾਂਜੀ ਚਲੋ ਕੋਈ ਨਹੀਂ ਫਿਰ ਵੀ ਮੈਂ ਇਹਦਾ ਵੀ ਹਾਂਜੀ ਹਾਂਜੀ ਆਪਾਂ ਨਾ ਦੋਨਾਂ ਦੋਨਾਂ ਸਕੂਲਾਂ 'ਚ ਨਾ ਪਤਾ ਕਰਕੇ ਫਿਰ ਦੇਖਦੇ ਹਾਂ ਕਿ ਕਿਹੜਾ ਬੈਸਟ ਹੈ ਆ ਅਤੇ ਕਿਸ ਲਈ ਫੀਸ ਸਟਰਕਚਰ ਹੈ ਆ ਬੱਚੇ ਨੂੰ ਕੀ ਕੀ ਫੈਸਿਲਿਟੀਆਂ ਸਹੂਲਤਾਵਾਂ ਦਿੰਦੇ ਪਏ ਆ ਮਿਲਦੇ ਆ ਫਿਰ ਆਪਾਂ ਇੱਕ ਦਿਨ ਹਾਂਜੀ ਹਾਂਜੀ ਠੀਕ ਓਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ